ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕ੍ਰਿਕਟ ਦਾ ਬਹੁਤ ਸ਼ੌਕੀਨ ਹਾਂ ਅਤੇ ਮੈਂ ਕ੍ਰਿਕਟ ਦੀ ਗੇਮ ਨੂੰ ਸੋਧਣ ਲਈ ਕਾਫੀ ਸਮੱਗਰੀ ਕੋਸ਼ਿਸ਼ ਕਿ ਕਰਦਾ ਰਹਿੰਦਾ ਇਕੱਠੀ ਕਰਨ ਦੀ ਬਾਕੀ ਜਦੋਂ ਅਸੀਂ ਗੇਮ ਖੇਡਣੀ ਹੋਏ ਤਾਂ ਮੇਰਾ ਦੋਸਤ ਅਤੇ ਮੈਂ ਕਦੀ ਉਹ ਮੈਂ ਬੈਟ ਲੈ ਆਉਂਦਾ ਉਹ ਬੋਲ ਲੈ ਆਉਂਦੇ ਆ ਬਾਕੀ ਥੋੜ੍ਹਾ ਥੋੜ੍ਹਾ ਰਲ ਮਿਲ ਕੇ ਸਾਰਾ ਸਮਾਨ ਇਕੱਠਾ ਕਰਕੇ ਕੋਈ ਕਿਸੇ ਨੇ ਵਿਕਟਾਂ ਲਈਆਂ ਹੋਈਆਂ ਨੇ ਸਾਰਾ ਸਮਾਨ ਇਕੱਠਾ ਕਰਕੇ

ਅਤੇ ਬਾਕੀ ਇਸ ਤੋਂ ਇਲਾਵਾ ਹੋਰ ਵੀ ਇੱਕ ਦੋ ਗੇਮਾਂ ਅਸੀਂ ਖੇਡ ਲੈਂਦੇ ਹਾਂ ਪਰ ਜ਼ਿਆਦਾ ਅਸੀਂ ਕ੍ਰਿਕਟ ਨੂੰ ਪਸੰਦ ਕਰਦੇ ਹਾਂ ਅਤੇ ਕ੍ਰਿਕਟ ਦੀ ਗੇਮ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਇਸ ਵਿੱਚ ਖਿਲਾੜੀ ਵੀ ਗਿਆਰਾਂ ਦਸ ਗਿਆਰਾਂ ਤੋਂ ਉੱਪਰ ਉੱਪਰ ਹੀ ਹੁੰਦੇ ਨੇ ਜਿਸ ਨਾਲ ਸਾਡੀ ਏਕਤਾ ਬਣੀ ਰਹਿੰਦੀ ਦੋਸਤ ਹਫਤੇ ਬਾਅਦ ਇਕੱਠੇ ਹੋ ਜਾਂਦੇ ਦੌੜ ਭੱਜ ਨਾਲ ਦੌੜ ਭੱਜ ਕਰਨ ਨਾਲ ਸਾਡਾ ਸਰੀਰ ਵੀ ਫਿਟ ਰਹਿੰਦਾ ਅਤੇ ਬਾਕੀ ਸਾਡੇ ਪਿੰਡ ਦੇ ਸਰਪੰਚ ਨੇ ਸਾਨੂੰ ਕਿੱਟ ਲੈ ਕੇ ਦਿੱਤੀ ਸੀ ਉਹਦੇ 'ਚ ਜਿਹੜਾ ਘਟਦਾ ਸਮਾਨ ਸੀਗਾ ਉਹ ਅਸੀਂ ਆਪਣਾ ਫਿਰ ਦੋਸਤਾਂ ਨੇ ਪੈਸੇ ਪਾ ਕੇ ਅਤੇ ਉਹ ਲਿਆ ਸੀਗਾ ਅਤੇ ਬਾਕੀ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਕ੍ਰਿਕਟ ਦੀ ਗੇਮ ਜਾਂ ਕੋਈ ਵੀ ਗੇਮ ਜ਼ਿੰਦਗੀ ਜ਼ਰੂਰ ਖੇਡਣੀ ਚਾਹੀਦੀ ਹੈ ਜਿਹਦੇ ਨਾਲ ਸਰੀਰ ਵੀ ਫਿਟ ਰਹਿੰਦਾ ਅਤੇ ਮਾਇੰਡ ਵੀ ਫਰੈਸ਼ ਰਹਿੰਦਾ ਅਤੇ ਬਾਕੀ ਤੁਸੀਂ ਜਿੰਨਾ ਹੋ ਸਕੇ ਅਤੇ ਵੱਧ ਤੋਂ ਵੱਧ ਗੇਮ ਵੱਲ ਧਿਆਨ ਦਿਉ ਕੰਮ ਕਰੋ ਪੜ੍ਹੋ ਲਿਖੋ